ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ਼ ਕਿ ਆਪਣਾ ਬੰਦਾ ਕੋਈ ਵੀ ਬਜ਼ਾਰ ਦੇ ਵਿੱਚ ਖਰੀਦਦਾਰੀ ਕਰਦਾ ਉਹਦੇ ਵਿੱਚ ਪੈਸੇ ਲੈਣ ਦੇਣ ਦੇ ਵਿੱਚ ਮਦਦ ਹੋ ਜਾਂਦੀ ਹੈ ਅੱਜ ਜਿਵੇਂ ਸਾਇੰਸ ਦਾ ਯੁੱਗ ਹੈ ਅਤੇ ਟੈਕਨੋਲੋਜੀ ਬਹੁਤ ਵੱਧ ਗਈ ਹੈ ਬੰਦੇ ਨੂੰ ਪੈਸੇ ਕਢਾਉਣ ਲੱਗੇ ਵੀ ਏ ਟੀ ਐੱਮ ਯੂਸ ਕਰਨੇ ਵਿੱਚ ਮੈਂ ਦੇਖਿਆ ਕਈ ਅਨਪੜ੍ਹ ਲੋਕ ਹੁੰਦੇ ਹੈ ਉਹ ਆਪਣਾ ਏ ਟੀ ਐੱਮ ਤੱਕ ਨਹੀਂ ਯੂਸ ਕਰ ਸਕਦੇ ਇਸ ਤਰ੍ਹਾਂ ਸਾਨੂੰ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦੇ ਕੰਮ ਕਰ ਸਕੀਏ